ਪਿੰਡ ਤਾਂ ਮੈਂ ਬਹੁਤ ਘੱਟ ਵਾਰ ਗਈ ਹਾਂ ਪਿੰਡ ਦਾ ਦੌਰਾ ਮੇਰਾ ਕਾਫੀ ਘੱਟ ਵਾਰ ਲੱਗਿਆ ਛੋਟੇ ਹੁੰਦੇ ਦੀ ਗੱਲ ਮੈਨੂੰ ਯਾਦ ਹੈ ਵੀ ਅਸੀਂ ਆਪਣੇ ਨਾਲ ਦੇ ਦੋਸਤ ਹੁੰਦੇ ਸੀ ਗੁਆਂਢੀ ਉਹਨਾਂ ਦੇ ਪਿੰਡ ਗਏ ਸੀ ਅਸੀਂ ਘੁੰਮਣ ਦੇ ਉਹਦੇ ਨਾਲ ਵੀ ਚਾਅ ਨਾਲ ਵੀ ਅਸੀਂ ਪਿੰਡ ਘੁੰਮਣਾ ਪਿੰਡ ਕਿੱਦਾਂ ਦਾ ਹੁੰਦਾ ਜਿੱਦਾਂ ਮੈਂ ਸ਼ਹਿਰ ਦੀ ਰਹਿਣ ਵਾਲੀ ਹਾਂ ਤਾਂ ਪਿੰਡ ਦਾ ਜਿਹੜਾ ਰਹਿਣ ਸਹਿਣ ਅਤੇ ਤੌਰ ਤਰੀਕਾ ਮੈਨੂੰ ਪਸੰਦ ਹੈ ਵੀ ਹਾਂ ਬਈ ਦੇਖਿਆ ਜਾਵੇ ਉਹ ਕਿਸ ਤਰ੍ਹਾਂ ਦਾ ਫਿਰ ਅਸੀਂ ਛੋਟੇ ਹੁੰਦੇ ਗਏ ਸੀਗੇ ਘੁੰਮਣ ਕਾਫੀ ਜ਼ਿਆਦਾ ਉੱਥੇ ਮਤਲਬ ਜਿਵੇਂ ਗਾਂ ਉਹ ਮੱਝਾਂ ਪਾਲਦੇ ਆ ਲੋਕ ਦੁੱਧ ਉਹਨਾਂ 'ਚੋਂ ਕਿੱਦਾਂ ਕੱਢੀਦਾ ਹੈ ਨਾ ਅਤੇ ਫਿਰ ਬੱਚੇ ਜਿਹੜੇ ਹੁੰਦੇ ਆ ਉਹ ਨਹਾਉਂਦੇ ਹੁੰਦੇ ਆ ਅਤੇ ਖੂਹ ਜਿਹਾ ਬਣਿਆ ਹੁੰਦਾ ਛੋਟਾ ਅਤੇ ਮੇਰਾ ਜਿਹੜਾ ਉਦੇਸ਼ ਸੀਗਾ ਉਸ ਸਮੇਂ ਦਾ ਛੋਟੇ ਹੁੰਦੇ ਮੰਤਵ ਨਾਲ ਵੀ ਮੈਂ ਘੁੰਮਣ ਦੇ ਪਰਪਸ ਨਾਲ ਗਈ ਸੀ ਬਾਕੀ ਮੈਂ ਹੋਰ ਜਿਹੜੇ ਨੇੜਲੇ ਕਸਬੇ ਹੈ ਉੱਥੇ ਮੈਂ ਜਿਵੇਂ ਜਲੰਧਰ ਚਲੀ ਜਾਂਦੀ ਹਾਂ ਮਲੇਰਕੋਟਲੇ ਚਲੇ ਜਾਂਦੇ ਹਾਂ ਅੰਬਾਲੇ ਚਲੇ ਜਾਂਦੇ ਹਾਂ ਉਹ ਅਸੀਂ ਕੱਪੜੇ ਦੇਖਣ ਲਈ ਵੀ ਕੱਪੜਿਆਂ ਦੀ ਪਟਿਆਲੇ ਤੋਂ ਵਿਭਿੰਨ ਵਰਾਇਟੀ ਕਿੱਦਾਂ ਹੈਗੀ ਵੀ ਕੱਪੜੇ ਅਲੱਗ ਕਿੱਦਾਂ ਮਿਲਦੇ ਨੇ ਉੱਥੇ ਵੀ ਰੇਟ ਦਾ ਕਾਫੀ ਜ਼ਿਆਦਾ ਫ਼ਰਕ ਹੈ ਹੈ ਨਾ ਵੀ ਕਾਫੀ ਹਰ ਚੀਜ਼ ਦਾ ਫ਼ਰਕ ਹੈ ਕੱਪੜੇ ਦੀ ਵਰਾਈਟੀ ਕਿਸ ਤਰ੍ਹਾਂ ਤਰ੍ਹਾਂ ਦੇ ਕੱਪੜੇ ਬਹੁਤ ਸਸਤੇ ਕੱਪੜੇ ਵੀ ਮਿਲਦੇ ਨੇ ਲੁਧਿਆਣੇ ਮਲੇਰਕੋਟਲੇ ਜਿੱਦਾਂ ਕਿ ਸੂਟਾਂ ਦੀ ਦੁਕਾਨ ਹੈਗੀ ਇੱਕ ਫੇਮਸ ਉੱਥੇ ਅਸੀਂ ਗਏ ਸੀਗੇ ਅਸੀਂ ਕੱਪੜਿਆਂ ਦੇ ਮੇਨ ਪਰਪਸ ਨਾਲ ਹੀ ਮਤਲਬ ਉਦੇਸ਼ ਜਿਹੜਾ ਸਾਡਾ ਇਹ ਹੁੰਦਾ ਵੀ ਅਸੀਂ ਕੱਪੜੇ ਖਰੀਦਣ ਜਾਣੇ ਹੈ ਜੇ ਕਿਸੇ ਹੋਰ ਸ਼ਹਿਰ ਦੇ ਵਿੱਚ ਜਾਣਾ ਅਤੇ ਬਾਕੀ ਜਦੋਂ ਜੇ ਅਸੀਂ ਘੁੰਮਣ ਜਾਣਾ ਹੁੰਦਾ ਤਾਂ ਅਸੀਂ ਹੋਰ ਕਸ ਜਿਵੇਂ ਕਿਸੇ ਅੰਮ੍ਰਿਤਸਰ ਚਲੇ ਜਾਂਦੇ ਹਾਂ ਘੁੰਮਣ ਮੀਨਸ ਕਿ ਦਰਸ਼ਨ ਕਰਨ ਮਹਾਰਾਜ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਲਈ ਅਤੇ ਮੇਰੇ ਜਿਹੜੇ ਰੀਸੈਂਟ ਜਿਹੜੇ ਹੋਏ ਨੇ ਮੈਂ ਲੁਧਿਆਣੇ ਮਲੇਰਕੋਟਲੇ ਅਤੇ ਅੰਬਾਲੇ ਇਸੇ ਪੱਖ ਤੋਂ ਗਈ ਹਾਂ ਵੀ ਉੱਥੇ ਜਾ ਕੇ ਕੱਪੜੇ ਦੇਖਾਂਗੇ ਅਤੇ ਕੱਪੜੇ ਅਗਰ ਸਸਤੇ ਮਿਲਦੇ ਹੋਏ ਤਾਂ ਜ਼ਰੂਰ ਅਸੀਂ ਉੱਥੋਂ ਦੀ ਕੱਪੜੇ ਜੁੱਤੀ ਹੋਰ ਵੀ ਸਮਾਨ ਜਿਹੜੇ ਸਮਾਨ ਉੱਥੋਂ ਦੀ ਸਾਨੂੰ ਪਟਿਆਲੇ ਤੋਂ ਫਰਕ ਦੇ ਨਾਲ ਮਿਲਦਾ ਹੈ ਉਹ ਅਸੀਂ ਦੇਖਣ ਵੀ ਜਾਂਦੇ ਹਾਂ ਆਪਣੇ ਮਾਤਾ ਜੀ ਨਾਲ ਮੈਂ ਅਤੇ ਜੋ ਸਾਨੂੰ ਪਸੰਦ ਆਉਂਦਾ ਉਹ ਅਸੀਂ ਖਰੀਦ ਕੇ ਵੀ ਲਿਆਉਂਦੇ ਹਾਂ ਧੰਨਵਾਦ ਜੀ